ਹਾਂਜੀ ਅਸੀਂ ਬਰਨਾਲੇ ਤੋਂ ਬੋਲ ਰਹੇ ਸੀ ਜੀ ਹਾਂਜੀ ਅਸੀਂ ਨਾ ਜ਼ੂ ਦਿਖਾਉਣਾ ਸੀ ਬੱਚਿਆਂ ਨੂੰ ਅਤੇ ਪੰਜ ਛੇ ਜਣੇ ਹੈਗੇ ਅਤੇ ਸਾਨੂੰ ਦੱਸੋਂਗੇ ਕੀ ਸ਼ਡਿਊਲ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅਤੇ ਅੱਛਾ ਜੀ ਕੇ ਕਿ ਕਿਹੜੇ ਦਿਨ ਖੁੱਲ੍ਹਾ ਰਹਿੰਦਾ ਜੀ ਇਹ ਅੱਛਾ ਜੀ ਕੀ ਫਸਿਲਟੀਜ ਦਿਓਂਗੇ ਤੁਸੀਂ ਸਾਨੂੰ ਬੱਚੇ ਹਾਂਜੀ ਬੱਚੇ ਹੈ ਜੀ ਸਾਡੇ ਨਾਲ ਅੱਛਾ ਜੀ ਅੱਛਾ ਜੀ ਅੱਛਾ ਜੀ ਸਾਡੇ ਨਾ ਬਜ਼ੁਰਗ ਵੀ ਉਹਨਾਂ ਨੂੰ ਕੀ ਕਰ ਕਰੋਗੇ ਤੁਸੀਂ ਅੱਛਾ ਜੀ ਅੱਛਾ ਜੀ ਖਾਣੇ ਪੀਣੇ ਦਾ ਪ੍ਰਬੰਧ ਹੈ ਜੀ ਕਿਉਂਕਿ ਬੱਚੇ ਨੇ ਨਾਲ ਉਹਨਾਂ ਨੂੰ ਭੁੱਖ ਲੱਗਦੀ ਹੈ ਫਿਰ ਉਹ ਤਾਂ ਬਾਰ ਬਾਰ ਕਹਿੰਦੇ ਆ ਅਸੀਂ ਇਹ ਖਾਣਾ ਅਸੀਂ ਇਹ ਖਾਣਾ ਕੀ ਪ੍ਰਬੰਧ ਆ ਖਾਣੇ ਦਾ ਵਧੀਆ ਕ ਖਾਣਾ ਕਿਵੇਂ ਹੈ ਅੱਛਾ ਜੀ ਸਾਰੇ ਵ ਵਧੀਆ ਜੀ ਅੱਛਾ ਜੀ ਹਾਂ ਸਾਫ਼ ਸਫਾਈ ਪੂਰੀ ਹੈ ਜੀ ਸਾਰਾ ਵਧੀਆ ਅੱਛਾ ਜੀ ਕੋਈ ਡਿਸਕਾਊਂਟ ਵਗੈਰਾ ਦਿੰਦੇ ਹੋ ਕਿ ਨਹੀਂ ਮਤਲਬ ਕੰਨਟੀਨ ਵਗੈਰਾ ਦੀ ਅੱਛਾ ਜੀ ਹੋਰ ਠੀਕ ਹੈ ਜੀ ਚੱਲੋ ਓਕੇ ਜੀ ਤੇ ਆ ਕੇ ਦੇਖਦੇ ਹਾਂ ਅਸੀਂ ਫਿਰ ਠੀਕ ਆ ਜੀ